ਸਾਡੇ ਪੰਜਾਬ ਦੇ ਵਿੱਚ ਦਿਵਾਲੀ ਇਹੋ ਜਿਹਾ ਤਿਉਹਾਰ ਆ ਕਿ ਮਤਲਬ ਇਹਨੂੰ ਹਰੇਕ ਕੋਈ ਸੈਲੀਬਰੇਟ ਕਰਦਾ ਅਤੇ ਇਹਦੇ ਵਿੱਚ ਮਤਲਬ ਰਾਮ ਜੀ ਅਯੋਧਿਆ ਤੋਂ ਚੌਦਾਂ ਸਾਲ ਬਾਅਦ ਮੁੜ ਕੇ ਆਏ ਸੀਗੇ ਅਤੇ ਉਸਦੀ ਯਾਦ ਵਿੱਚ ਇਸਨੂੰ ਤਾਜ਼ਾ ਕਰਨ ਵਾਸਤੇ ਮਤਲਬ ਮਨਾਇਆ ਜਾਂਦਾ ਹੈ ਅਤੇ ਇਹਦੇ ਵਿੱਚ ਮਤਲਬ ਲੋਕ ਆਪਣੇ ਘਰਾਂ ਦੀ ਸਾਫ ਸਫਾਈ ਕਰਦੇ ਹਨ ਅਤੇ ਕਿਉਂਕਿ ਉਸ ਦਿਨ ਲਕਛਮੀ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ ਕਿਤੇ ਲਕਛਮੀ ਮਾਤਾ ਸਾਰਿਆਂ ਦੇ ਘਰਾਂ ਆਉਂਦੀ ਆ ਤਾਂ ਲੋਕ ਆਪਣੇ ਸਾਰੇ ਘਰਾਂ ਦੇ ਬਾਹਰ ਦੀਵੇ ਜਾਲ ਦੇ ਆ ਦੀਵਲ ਜਾਲ ਕੇ ਰੱਖਦੇ ਹਨ ਅਤੇ ਉਸ ਦਿਨ ਲੋਕ ਮਿਠਾਈਆਂ ਖਰੀਦਦੇ ਹਨ ਨਵੇਂ ਨਵੇਂ ਕੱਪੜੇ ਪਾਉਂਦੇ ਹਨ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਠਿਆਈਆਂ ਦਿੰਦੇ ਹਨ ਭੇਜਦੇ ਹਨ ਅਤੇ ਖੁਸ਼ੀਆਂ ਦਿੰਦੇ ਹਨ ਵਧਾਈਆਂ ਦਿੰਦੇ ਹਨ ਅਤੇ ਮਤਲਬ ਹੋਰ ਵੀ ਇਹਦੇ ਵਿੱਚ ਮਤਲਬ ਇੱਦਾਂ ਹੈ ਕਿ ਮਤਲਵ ਇਹਨੂੰ ਸਿੱਖਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਪਰ ਇਸਨੂੰ ਜ਼ਿਆਦਾਤਰ ਹਿੰਦੂ ਅਤੇ ਮਤਲਵ ਸਿੱਖ ਮਨਾਉਂਦੇ ਹਨ ਕਿਉਂਕਿ ਇਹ ਮਤਲਵ ਦੀਵਾਲੀ ਦਾ ਮਤਲਬ ਬਹੁਤ ਜ਼ਿਆਦਾ ਆਨੰਦ ਲੈਂਦੇ ਹਨ ਅਤੇ ਦਿਵਾਲੀ ਦੇ ਵਿੱਚ ਲੋਕ ਨਵੇਂ ਨਵੇਂ ਕੱਪੜੇ ਪਾਉਂਦੇ ਹਨ ਅਤੇ ਪਟਾਕੇ ਵੀ ਫੋੜਦੇ ਹਨ ਕਈ ਬੰਦੇ ਅਤੇ ਮਤਲਬ ਜ਼ਿਆਦਾਤਰ ਇਸਨੂੰ ਮਤਲਵ ਪੰਜਾਬ ਦਾ ਸਭ ਤੋਂ ਜ਼ਿਆਦਾ ਬੜਾ ਤਿਉਹਾਰ ਦਿਵਾਲੀ ਮੰਨਿਆ ਜਾਂਦਾ ਹੈ